ਖਾਣਾ ਬਣਾਉਣ ਦੀ ਤਕਨੀਕ ਤਾਂ ਹਰ ਇੱਕ ਔਰਤ ਦੇ ਕੋਲ ਹੈ ਪਰ ਉਸ ਖਾਣੇ ਨੂੰ ਵਧੀਆ ਕਿਸ ਤਰ੍ਹਾਂ ਬਣਾਉਣਾ ਹੈ ਸਵਾਦ ਕਿਸ ਤਰ੍ਹਾਂ ਬਣਾਉਣਾ ਹੈ ਇਹ ਜਾਚ ਕਿਸੇ ਕਿਸੇ ਨੂੰ ਆਉਂਦੀ ਹੈ ਜਿਵੇਂ ਕਿ ਮੈਨੂੰ ਖਾਣ ਖਵਾਉਣ ਦਾ ਬਣਾਉਣ ਦਾ ਬਹੁਤ ਸ਼ੌਕ ਹੈ ਇਸ ਲਈ ਮੈਨੂੰ ਹੁੰਦਾ ਹੈ ਕਿ ਜਿਹੜਾ ਵੀ ਸਾਡੇ ਘਰ ਕੋਈ ਗੈਸਟ ਵਗੈਰਾ ਜਾਂ ਕੋਈ ਪਰਾਹੁਣਾ ਆਇਆ ਤਾਂ ਖਾਏ ਬਿਨਾਂ ਨਾ ਜਾਏ ਫਿਰ ਮੈਨੂੰ ਆਸ ਹੈ ਕਿ ਮੈਂ ਹਰ ਇੱਕ ਚੀਜ਼ ਆਪ ਬਣਾਉਂਦੀ ਹਾਂ ਖਾਣਾ ਸਵਾਦ ਅਸੀਂ ਬਣਾ ਸਕਦੇ ਹਾਂ ਕਿਉਂਕਿ ਸਾਡੀ ਰਸੋਈ ਦੇ ਵਿੱਚ ਇੱਕ ਮਸਾਲੇ ਜਿਹੜੇ ਨੇ ਸਾਡੇ ਸਾਥ ਦਿੰਦੇ ਨੇ ਇੱਕ ਪਿਆਰ ਸਾਡਾ ਜਿਹੜਾ ਕਿ ਅਸੀਂ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜੇਕਰ ਕੋਈ ਵੀ ਚੀਜ਼ ਤਿਆਰ ਕਰਾਂਗੇ ਤਾਂ ਉਹ ਖਾਣੇ ਦਾ ਜਿਹੜਾ ਸਵਾਦ ਹੈ ਨਾ ਅੰਤਾਂ ਦਾ ਵਧ ਜਾਂਦਾ ਹੈ ਖਾਣੇ ਦੇ ਵਿੱਚ ਸਾਨੂੰ ਮਸਾਲੇ ਉਹ ਵਰਤਣੇ ਚਾਹੀਦੇ ਨੇ ਜਿਹੜੇ ਕਿ ਸਾਡੀ ਸਿਹਤ ਵਾਸਤੇ ਠੀਕ ਹੋਣ ਇਹ ਨਹੀਂ ਕਿ ਹਰ ਇੱਕ ਮਸਾਲਾ ਅਸੀਂ ਹਰ ਇੱਕ ਚੀਜ਼ ਪਾ ਦਈਏ ਜਿਸ ਚੀਜ਼ ਦੇ ਵਿੱਚ ਜਿਸ ਮਸਾਲੇ ਦੀ ਲੋੜ ਹੈ ਲੋੜ ਅਨੁਸਾਰ ਉਹੀ ਸਾਨੂੰ ਮਸਾਲਾ ਵਰਤਨਾ ਚਾਹੀਦਾ ਹੈ ਨਮਕ ਘੱਟ ਤੋਂ ਘੱਟ ਵਰਤੋ ਜਿਹੜੀ ਹਲਦੀ ਹੈ ਉਹ ਅਸੀਂ ਬਾਜ਼ਾਰ ਤੋਂ ਲੈ ਕੇ ਵਰਤਦੇ ਹਾਂ ਪਰ ਜੇਕਰ ਅਸੀਂ ਕੱਚੀ ਹਲਦੀ ਦੀ ਵਰਤੋਂ ਕਦੀ ਕਰੀਏ ਤਾਂ ਸਾਡੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੈ ਇੱਕ ਅਦਰਕ ਦਾ ਕੰਮ ਕਰਦੀ ਹੈ ਅਤੇ ਜਿਹੜੀ ਕਿ ਸਾਡੇ ਸਰੀਰ ਨੂੰ ਨੁਕਸਾਨ ਵੀ ਨਹੀਂ ਕਰਦੀ ਜਿਹੜੇ ਸਾਨੂੰ ਮਸਾਲੇ ਨੇ ਆਪ ਪੀਸਣੇ ਚਾਹੀਦੇ ਨੇ ਬਾਜ਼ਾਰੋਂ ਖੜ੍ਹੇ ਮਸਾਲੇ ਲਿਆ ਕੇ ਸਾਨੂੰ ਘਰ ਦੇ ਵਿੱਚ ਆਪ ਪੀਸਣੇ ਚਾਹੀਦੇ ਹੈ ਜਿਹਦੇ ਨਾਲ ਕਿ ਉਨ੍ਹਾਂ ਦੀ ਮਿਆਦ ਵੀ ਵਧ ਜਾਂਦੀ ਹੈ ਅਸਰ ਵੀ ਵਧ ਜਾਂਦਾ ਹੈ ਬਾਜ਼ਾਰ ਦੇ ਪੀਸੇ ਮਸਾਲਿਆਂ ਵਿੱਚ ਪਤਾ ਨਹੀਂ ਕੀ ਪਾਇਆ ਹੁੰਦਾ ਜਿਹਦੇ ਨਾਲ ਕਿ ਸਾਰੀ ਚੀਜ਼ ਬਣਾਈ ਦਾ ਹੀ ਸਵਾਦ ਖ ਖਰਾਬ ਹੋ ਜਾਂਦਾ ਹੈ